ਹਾਂ ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਆਪਣੇ ਕੋਲਜ ਦੇ ਦਿਨਾਂ ਦੇ ਵਿੱਚ ਗ੍ਰੈਜੂਏਸ਼ਨ ਕਰਦਾ ਹੁੰਦਾ ਸੀ ਤਾਂ ਸਾਡੇ ਇੱਕ ਯੂਥ ਫੈਸਟੀਵਲ ਨਾਮ ਦਾ ਜਿਹੜਾ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਸੀ ਹਰ ਸਾਲ ਉਹ ਫੰਕਸ਼ਨ ਮਨਾਇਆ ਜਾਂਦਾ ਸੀ ਜਿਸ ਦੇ ਵਿੱਚ ਤਰ੍ਹਾਂ ਤਰ੍ਹਾਂ ਦੀ ਮਤਲਬ ਫੰਕਸ਼ਨ ਰੱਖੇ ਜਾਂਦੇ ਸਨ ਕਲਾਕ੍ਰਿਤੀਆਂ ਦਿਖਾਈਆਂ ਜਾਂਦੀਆਂ ਸਨ ਬੱਚੇ ਆਪਣਾ ਟੈਲੈਂਟ ਆ ਜਿਹੜਾ ਉਹ ਉਭਾਰ ਕੇ ਸਾਹਮਣੇ ਲੈ ਕੇ ਆਉਂਦੇ ਸਨ ਤਾਂ ਸ਼ੁਰੂ ਤੋਂ ਹੀ ਮੇਰਾ ਰਿਹਾ ਹੈ ਸੀ ਕਿ ਵੀ ਮੈਂ ਇੱਕ ਭੰਗੜਾ ਜਿਹੜਾ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਹੈ ਡਾਂਸ ਹੈ ਉਹ ਸਿੱਖਾਂ ਅਤੇ ਉਸ ਨੂੰ ਇੱਕ ਸਟੇਜ ਦੇ ਉੱਤੇ ਨ ਸਟੂਡੈਂਟਸ ਦੇ ਸਾਹਮਣੇ ਜਿਹੜਾ ਪ੍ਰਜੈਂਟ ਕਰਾਂ ਪੇਸ਼ ਕਰਾਂ ਤਾਂ ਉਸ ਸਮੇਂ ਸਾਡੇ ਕਾਲਜ ਦੇ ਵਿੱਚ ਇੱਕ ਟੀਮ ਬੁਲਾਈ ਗਈ ਜਿਸ ਨੇ ਸਾਨੂੰ ਅ ਇੱਕ ਭੰਗੜੇ ਦੇ ਕੋਚ ਸੀ ਉਹਨਾਂ ਨੇ ਸਾਨੂੰ ਸਾਰੇ ਭੰਗੜੇ ਦੇ ਸਟੈਪਾ ਬਾਰੇ ਸਾਨੂੰ ਅ ਜਾਣੂ ਕਰਵਾਇਆ ਸਾਨੂੰ ਸਿਖਾਇਆ ਮੈਨੂੰ ਤਕਰੀਬਨ ਵੀਹ ਤੋਂ ਪੱਚੀ ਦਿਨ ਲੱਗ ਗਏ ਜਿਹੜੇ ਆ ਭੰਗੜੇ ਦੀ ਪ੍ਰੈਕਟਿਸ ਕਰਦੇ ਹੋਏ ਤਾਂ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਉਸ ਨੂੰ ਡਾਂਸ ਨੂੰ ਸਿੱਖਿਆ ਤਾਂ ਹਾਂ ਜਿਹੜੀ ਗੱਲ ਹੈ ਕਿ ਜਦੋਂ ਅਸੀਂ ਸਟੇਜ ਦੇ ਉੱਪਰ ਪਰਫੋਰਮ ਕਰਨਾ ਸੀ ਤਾਂ ਜਿਹੜੀ ਸਾਡੀ ਕੋਰੀਓਗ੍ਰਾਫੀ ਹੈ ਜਿਹੜੀ ਸਾਡੀ ਵੀਡੀਓ ਫੁਟੇਜ ਤਿਆਰ ਕੀਤੀ ਗਈ ਤਾਂ ਉਹ ਕਾਲਜ ਦੇ ਵੱਲੋਂ ਤਿਆਰ ਕੀਤੀ ਗਈ ਤਾਂ ਜਿਹੜੀ ਸਾਡੇ ਫੰਕਸ਼ਨ ਹੋਏ ਉਹਦੇ ਵਿੱਚ ਕਲਾਕ੍ਰਿਤੀਆਂ ਦਿਖਾਈਆਂ ਗਈਆਂ ਡਾਂਸ ਕੀਤਾ ਗਿਆ ਉਸ ਦੇ ਵਿੱਚ ਸਭ ਤੋਂ ਵਧੀਆ ਜਿਹੜਾ ਉਹ ਫੰਕਸ਼ਨਾਂ ਦੇ ਵਿੱਚੋਂ ਸੀ ਜਿਹੜਾ ਉਹ ਸਿਰਫ਼ ਡਾਂਸ ਭੰਗੜੇ ਦਾ ਹੀ ਸੀ ਅਤੇ ਜੋ ਕਿ ਲੋਕਾਂ ਨੂੰ ਬਹੁਤ ਪਸੰਦ ਆਇਆ ਅਤੇ ਲੋਕਾਂ ਨੇ ਉਸ ਨੂੰ ਪਸੰਦ ਕੀਤਾ ਅਤੇ ਮੈਂ ਵੀ ਜਿਹੜਾ ਭੰਗੜਾ ਹੈ ਅਸੀਂ ਉਹ ਡਾਂਸ ਕਰਕੇ ਬਹੁਤ ਖੁਸ਼ ਸੀ ਅਤੇ ਬਹੁਤ ਆਰਾਮ ਦੇ ਨਾਲ ਬੜੇ ਚਾਅ ਦੇ ਨਾਲ ਉਸ ਭੰਗੜੇ ਨੂੰ ਕੀਤਾ ਅਤੇ ਆਪਣੀ ਕੋਰੀਓਗ੍ਰਾਫੀ ਤਿਆਰ ਕਰਵਾਈ